ਜੇ ਮੈਂ ਤੁਹਾਨੂੰ ਤਰਨ ਤਾਰਨ ਦੇ ਮੌਸਮ ਬਾਰੇ ਦੱਸਾਂ ਇੱਥੇ ਗਰਮੀਆਂ ਵਿੱਚ ਤੋਂ ਖੂਬ ਗਰਮੀ ਪੈਂਦੀ ਹੈ ਅਤੇ ਸਰਦੀਆਂ ਵਿੱਚ ਬਹੁਤ ਹੀ ਜ਼ਿਆਦਾ ਸਰਦੀ ਪੈਂਦੀ ਹੈ ਕਈ ਵਾਰੀ ਤਾਂ ਨੈਗੇਟਿਵ ਤੱਕ ਵੀ ਟੈਂਪਰੇਚਰ ਚਲਾ ਜਾਂਦਾ ਹੈ ਇੱਥੋਂ ਦੇ ਜਦੋਂ ਸਰਦੀਆਂ ਦੇ ਵਿੱਚ ਜੇ ਮੈਂ ਹਾਲ ਦੀ ਗੱਲ ਕਰਾਂ ਅਤੇ ਸਰਦੀਆਂ ਦੇ ਵਿੱਚ ਮੌਸਮ ਇੰਨਾ ਜ਼ਿਆਦਾ ਠੰਡਾ ਸੀ ਕਿ ਲੋਕਾਂ ਦੇ ਮਤਲਬ ਕੰਮ ਕਾਜ 'ਚ ਵੀ ਬੜਾ ਫਰਕ ਪੈਂਦਾ ਹੈ